ਮੇਰੀ ਰੈਸਪੀ ਵਿੱਚ ਮੈਂ ਜੋ ਵੀ ਚੀਜ਼ਾਂ ਵਰਤਦੀ ਹਾਂ ਉਹ ਮਿਲਣਾ ਕੋਈ ਦੁਰਲਭ ਗੱਲ ਨਹੀਂ ਹੈ ਕਿਉਂਕਿ ਮੈਂ ਸਾਰੀ ਸਧਾਰਨ ਚੀਜ਼ਾਂ ਹੀ ਵਰਤਦੀ ਹਾਂ ਅਤੇ ਜੋ ਹੈ ਉਹ ਸਾਰਾ ਸਮਾਨ ਮੈਨੂੰ ਬਾਜ਼ਾਰੋਂ ਆਸਾਨੀ ਨਾਲ ਮਿਲ ਜਾਂਦਾ ਹੈ ਲਾਲ ਮਿਰਚ ਹਲਦੀ ਪਾਊਡਰ ਨਮਕ ਸਾਰਾ ਸਮਾਨ ਹੀ ਸਾਨੂੰ ਆਸਾਨੀ ਨਾਲ ਜੋ ਹੈ ਬਾਜ਼ਾਰਾਂ ਵਿੱਚ ਮਿਲ ਜਾਂਦਾ ਹੈ ਅਤੇ ਉਹਨਾਂ ਨੂੰ ਪ੍ਰਾਪਤ ਕਰਨਾ ਕੋਈ ਦੁਰਲਭ ਗੱਲ ਨਹੀਂ ਹੈ